ਅਸੀਂ ਗ੍ਰਹਿਆਂ ਤੋਂ ਲੈ ਕੇ ਗਲੈਕਸੀਆਂ ਤੱਕ ਇਹਨਾਂ ਦਾ ਵੱਖ ਵੱਖ ਤਰੀਕਿਆਂ ਨਾਲ ਪੈਮਾਨਾ ਕਰ ਸਕਦੇ ਹਾਂ ਸਾਡੇ ਆਕਾਸ਼ ਦੇ ਵਿੱਚ ਲਗਭਗ ਅੱਠ ਪਲੈਨਿਟ ਹਨ ਜਿਨਾਂ ਦਾ ਨਾਮ ਹੈ ਬੁੱਧ ਸ਼ੁੱਕਰ ਅਤੇ ਧਰਤੀ ਇਸ ਤੋਂ ਇਲਾਵਾ ਵੀ ਪਲੈਨਿਟ ਹਨ ਪਹਿਲਾਂ ਨੌ ਪਲੈਨਿਟ ਹੁੰਦੇ ਸਨ ਜਿਹਨਾਂ ਵਿੱਚ ਇੱਕ ਪਲੈਨਿਟ ਪਲੂਟੋ ਵੀ ਸੀ ਪਰ ਇੰਟਰਨੈਸ਼ਨਲ ਸਾਇੰਟਿਸਟ ਮੀਟਿੰਗ ਦੇ ਦੌਰਾਨ ਇਸ ਨੂੰ ਪਲੈਨਿਟ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਇਸ ਨੂੰ ਪਲੈਨਿਟਾਂ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਕਿਉਂਕਿ ਇਸਦਾ ਪਾਥ ਕੁਛ ਵੀ ਕਲੀਅਰ ਨਹੀਂ ਸੀ ਇਹ ਆਪਣੀਆਂ ਦਿਸ਼ਾਵਾਂ ਬਦਲਦਾ ਰਹਿੰਦਾ ਸੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਧਰੂਵ ਤਾਰੇ ਦੀ ਅਤੇ ਧਰੂਵ ਤਾਰਾ ਇੱਕ ਮੈਜ਼ਰਮੈਂਟ ਸਟਾਰ ਹੈ ਜਿਸ ਨਾਲ ਆਪਾਂ ਪੈਮਾਨਾ ਕਰਦੇ ਹਾਂ ਅਗਰ ਗੱਲ ਕੀਤੀ ਜਾਵੇ ਧਰਤੀ ਦੀ ਤਾਂ ਧਰਤੀ ਇੱਕ ਇਕੱਲਾ ਐਸਾ ਗ੍ਰਹਿ ਹੈ ਜਿਸ 'ਤੇ ਮਨੁੱਖੀ ਜੀਵਨ ਸੰਭਵ ਹੈ ਅਗਰ ਗੱਲ ਕੀਤੀ ਜਾਵੇ ਬਲੈਕ ਹੋਲ ਦੀ ਤਾਂ ਇਸਦਾ ਮਾਸ ਸੂਰਜ ਤੋਂ ਤਿੰਨ ਗੁਣਾ ਜ਼ਿਆਦਾ ਹੈ ਇਸ ਦੀ ਗਰੈਵੀਟੇਸ਼ਨਲ ਪਾਵਰ ਵੀ ਬਹੁਤ ਜ਼ਿਆਦਾ ਹੈ ਇਹਨਾਂ ਤਰੀਕਿਆਂ ਤੋਂ ਇਲਾਵਾ ਵੀ ਅਸੀਂ ਹੋਰ ਕਈ ਵਿਵਹਾਰਾਂ ਨਾਲ ਇਹਨਾਂ ਦਾ ਅਧਿਐਨ ਕਰ ਸਕਦੇ ਹਨ ਇਹਨਾਂ ਦੀਆਂ ਕਾਫੀ ਵਿਸ਼ੇਸ਼ਤਾਵਾਂ ਹੈ ਜੋ ਵੱਖ ਵੱਖ ਅੱਠ ਪਲੈਨਿਟ ਨੇ ਇਹਨਾਂ ਦੀ ਅਲੱਗ ਅਲੱਗ ਸ਼ੇਪ ਹੁੰਦੀ ਹੈ ਜਿਵੇਂ ਕਿ ਸਪੀਡਲ ਗੋਲਾਕਾਰ ਇਰਲੈਗੂਲਰ ਸ਼ੇਪ ਜਿਹੜੀ ਸਾਡੀ ਗਲੈਕਸੀ ਹੈ ਉਸਦਾ ਨਾਮ ਮਿਲਕੀ ਵੇ ਹੈ ਜੋ ਕਿ ਸਪਿਰਲ ਸ਼ੇਪ ਦੀ ਹੈ